ਨਿੱਜੀ ਜੀਵਨ ਵਿੱਚ ਆਪਣੀਆਂ ਬਹੁਤ ਸਾਰੀਆਂ ਇੱਛਾਵਾਂ ਹੁੰਦੀਆਂ ਹਨ ਪਰ ਮੈਂ ਆਪਣੀ ਨਿੱਜੀ ਇੱਛਾ ਆਪਣਾ ਇੱਕ ਬਿਜ਼ਨਸ ਸਟਾਰਟ ਕਰਨਾ ਚਾਹੁੰਦੀ ਹਾਂ ਜਿਹਦੇ ਲਈ ਮੈਂ ਬਹੁਤ ਸਾਰੀਆਂ ਕਮਿਊਨੀਕੇਸ਼ਨ ਸਕਿੱਲ ਸਿੱਖ ਰਹੀ ਹਾਂ ਨਵੀਆਂ ਨਵੀਆਂ ਔਪਰਚੂਨਿਟੀਸ ਦੇ ਵਿੱਚ ਆਪਣੇ ਨਵੇਂ ਨਵੇਂ ਐਕਸਪੀਰੀਐਂਸ ਪ੍ਰਾਪਤ ਕਰ ਰਹੀ ਹਾਂ ਅਤੇ ਆਪਣੀ ਸਟੱਡੀ 'ਤੇ ਫੋਕਸ ਕਰ ਰਹੀ ਹਾਂ ਵੈਸੇ ਤਾਂ ਮੈਂ ਇਸ ਵਰਕ ਲਈ ਆਪਣਾ ਜੋਬ ਦਾ ਐਕਸਪੀਰੀਐਂਸ ਵੀ ਲੈਣਾ ਚਾਹੁੰਦੀ ਹਾਂ ਤਾਂ ਕਿ ਮੈਨੂੰ ਪਤਾ ਲੱਗੇ ਅਤੇ ਇੱਕ ਜੋਬ ਅਤੇ ਇੱਕ ਬਿਜ਼ਨਸ ਦੇ ਵਿੱਚ ਕੀ ਅੰਤਰ ਆਉਂਦਾ ਹੈ ਅਤੇ ਮੈਂ ਆਪਣੇ ਬਿਜ਼ਨਸ ਨੂੰ ਜੋਬ ਨਾਲੋ ਕਿਵੇਂ ਸੁਖਾਲਾ ਬਣਾ ਸਕਦੀ ਹਾਂ ਹੁਣ ਆਪਾਂ ਜੋਬ ਵਿੱਚ ਦੇਖਦੇ ਹਾਂ ਕਿ ਬਹੁਤ ਸਾਰੇ ਪਰਸਨ ਇੱਕ ਪਰਸਨ ਦੇ ਅੰਡਰ ਕੰਮ ਕਰ ਰਹੇ ਹੁੰਦੇ ਆ ਤਾਂ ਮੈਂ ਉਸ ਚੀਜ਼ ਨੂੰ ਛੱਡ ਕੇ ਇੱਕ ਬਹੁਤ ਸਾਰੇ ਲੋਕਾਂ ਨੂੰ ਖੁਦ ਦਾ ਇੱਕ ਮਕਸਦ ਦੇਣਾ ਚਾਹੁੰਦੀ ਹਾਂ ਕਿ ਉਹ ਖੁਦ ਇੱਕ ਅਪਰਚੂਨਿਟੀ ਬਣਨ ਅਤੇ ਦੂਜਿਆਂ ਨੂੰ ਵੀ ਓਹ ਮੌਕੇ ਪ੍ਰਦਾਨ ਕਰਨ